ਪੰਜਾਬੀ ਭਾਸ਼ਾ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਬਾਕੀ ਭਾਸ਼ਾਵਾਂ ਨੇ ਜਿਵੇਂ ਕਿ ਆਪਾਂ ਅੰਗਰੇਜ਼ੀ ਭਾਸ਼ਾ ਦੀ ਗੱਲ ਕਰਦੇ ਹਾਂ ਅੰਗਰੇਜ਼ੀ ਭਾਸ਼ਾ ਇੱਕ ਇੰਟਰਨੈਸ਼ਨਲ ਭਾਸ਼ਾ ਹੈ ਹੁਣ ਮਾਂ ਬਾਪ ਆਪਣੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਸਿਖਾਉਣ ਦੀ ਬਜਾਏ ਇੰਟਰਨੈਸ਼ਨਲ ਭਾਸ਼ਾ ਅੰਗਰੇਜ਼ੀ ਸਿਖਾਉਣ ਦੇ ਵਿੱਚ ਹੀ ਆਪਣਾ ਫਾਇਦਾ ਸਮਝਦੇ ਹਨ ਉਹ ਪੰਜਾਬੀ ਨੂੰ ਜ਼ਿਆਦਾ ਤਰਜੀਹ ਨਹੀਂ ਦਿੰਦੇ ਉਹ ਸਮਝਦੇ ਹਨ ਕਿ ਪੰਜਾਬੀ ਵਿੱਚ ਗੱਲ ਕਰਨਾ ਸਾਡੇ ਬੱਚਿਆਂ ਦਾ ਘਟਾਓ ਹੈ ਉਹ ਉਸ ਨੂੰ ਇੰਟਰਨੈਸ਼ਨਲ ਲੈਵਲ ਦੀ ਲੈਂਗੂਏਜ ਹੀ ਸਿਖਾਉਣਾ ਚਾਹੁੰਦੇ ਹਨ ਤਾਂ ਕਿ ਉਹ ਉੱਧਰ ਜਾ ਕੇ ਵਧੀਆ ਸੈਟੱਲ ਹੋ ਸਕਣ ਅਤੇ ਪੰਜਾਬੀ ਭਾਸ਼ਾ ਨੂੰ ਇੰਨੀ ਤਰਜੀਹ ਨਹੀਂ ਦਿੰਦੇ